ਹੈਲੋ ਨਮਸਕਾਰ ਜੀ ਮੈਮ ਮੈਂ ਤੋਂ ਤਰੁਨ ਗੱਲ ਕਰ ਰਿਹਾ ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦਾ ਨਮਸਕਾਰ ਮੈਮ ਬਿਲਕੁਲ ਮੈਮ ਮੈਂ ਬਿਲਕੁਲ ਪੂਰੀ ਜਾਣਕਾਰੀ ਦੇਵਾਂਗਾ ਤੁਹਾਨੂੰ ਪਰ ਇਹ ਜਾਣਕਾਰੀ ਦੇਣ ਤੋਂ ਪਹਿਲਾਂ ਮੈਨੂੰ ਥੋੜ੍ਹੀ ਜਿਹੀ ਤੁਹਾਡੇ ਕੋਲੋਂ ਜਾਣਕਾਰੀ ਚਾਹੀਦੀ ਹੋਵੇਗੀ ਸੋ ਤਾਂ ਜੋ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਗਾਈਡ ਕਰ ਪਾਵਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕੀ ਤੁਸੀਂ ਕਿੰਨੇ ਜਣੇ ਜਾ ਰਹੇ ਹੋ ਮੈਮ ਟ੍ਰਿਪ 'ਤੇ ਠੀਕ ਹੈ ਮੈਮ ਅਤੇ ਕਿੰਨੇ ਦਿਨਾਂ ਦਾ ਤੁਸੀਂ ਟ੍ਰਿਪ ਪਲੈਨ ਕਰ ਰਹੇ ਹੋ ਵਨ ਵੀਕ ਮਤਲਬ ਮੈਡਮ ਸਿਕਸ ਨਾਈਟਸ ਸੈਵਨ ਡੇਸ ਗੱਲ ਕਰ ਰਹੇ ਹੈ ਕਰ ਰਹੇ ਹੋ ਕਿ ਤੁਸੀਂ ਠੀਕ ਹੈ ਜੀ ਅਤੇ ਮੈਮ ਕਿਹੜੇ ਮੰਥ ਦਾ 'ਚ ਤੁਸੀਂ ਪਲੈਨ ਆਊਟ ਕਰ ਰਹੇ ਹੋ ਮੈਂ ਉਸ ਹਿਸਾਬ ਨਾਲ ਫਿਰ ਤੁਹਾਨੂੰ ਪ੍ਰੋਪਰ ਪੈਕੇਜ ਦੱਸ ਦਾਂਗਾ ਦਸੰਬਰ ਦੇ ਲਾਸਟ 'ਚ ਬਿਲਕੁਲ ਮੈਮ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ ਕਿਆ ਮੈਂ ਇੱਕ ਮਿੰਟ ਲਈ ਤੁਹਾਡੀ ਕੌਲ ਹੋਲਡ ਕਰ ਸਕਦਾ ਜੀ ਠੀਕ ਮੈਮ ਬਹੁਤ ਬਹੁਤ ਸ਼ੁਕਰੀਆ ਜੀ ਮੈਮ ਦਿਸੰਬਰ ਵੈਸੇ ਬਹੁਤ ਅੱਛਾ ਟਾਈਮ ਹੈ ਮਲੇਸ਼ੀਆ ਜਿਹੜਾ ਘੁੰਮਣ ਦਾ ਬੈਸਟ ਮੰਥ ਹੁੰਦਾ ਹੈ ਐਪਰਲ ਟੂ ਅਕਤੁਬਰ ਹੁੰਦਾ ਅਤੇ ਦਿਸੰਬਰ ਟੂ ਮਾਰਚ ਰਹਿੰਦਾ ਹੈ ਬੈਸਟ ਕੋਸਟ ਜਿਹੜਾ ਹੈਗਾ ਹੈ ਏਰੀਆ ਉਹਨੂੰ ਘੁੰਮਣ ਲਈ ਅਤੇ ਜਿਵੇਂ ਕਿ ਤੁਸੀਂ ਦੱਸਿਆ ਮੈਨੂੰ ਕਿ ਤੁਸੀਂ ਔਰ ਤੁਹਾਡੇ ਹਸਬੈਂਡ ਜਾਣਾ ਚਾਹੁੰਦੇ ਨੇ ਅਤੇ ਮੈਂ ਜੇ ਤੁਸੀਂ ਚਾਹੋ ਤਾਂ ਆਪਾਂ ਇਹਨੂੰ ਥੋੜ੍ਹਾ ਜਿਹਾ ਐਡਵੈਂਚਰਸ ਟ੍ਰਿਪ ਵੀ ਬਣਾ ਸਕਦੇ ਹਾਂ ਬਾਕੀ ਤੁਹਾਡੀ ਕੌਲ ਹੈ ਤੁਸੀਂ ਐਡਵੈਂਚਰਸ ਟ੍ਰਿਪ ਕਹੂੰਗੇ ਤਾਂ ਆਪਾਂ ਉਹਦੇ ਉੱਤੇ ਕੰਮ ਕਰ ਸਕਦੇ ਜੇ ਤੁਸੀਂ ਕਹੂੰਗੇ ਕਿ ਰਿਲੈਕਸ ਮੋਡ ਵਾਸਤੇ ਜਾਣਾ ਤਾਂ ਆਪਾਂ ਉਹਦੇ 'ਤੇ ਵੀ ਕੰਮ ਕਰ ਸਕਦੇ ਹੈ ਅਤੇ ਤੁਸੀਂ ਕਿੱਦਾਂ ਦਾ ਟ੍ਰਿਪ ਜੀ ਮੈਮ ਠੀਕ ਹੈ ਮੈਮ ਅਸੀਂ ਫਿਰ ਇਸ ਤਰ੍ਹਾਂ ਕਰਦੇ ਹਾਂ ਮੈਂ ਤੁਹਾਡੇ ਲਈ ਪਲੈਨ ਕਰਦਾ ਹੈਗਾ ਜਿਹਦੇ 'ਤੇ ਤੁਹਾਡਾ ਰਿਲੈਕਸ਼ੇਸ਼ਨ ਦਾ ਰਹੇ ਜ਼ਿਆਦਾ ਰਿਲੈਕਸ ਦਮ ਹੋਵੇ ਵਿੱਚ ਇੱਕ ਦੋ ਦਿਨ ਆਪਾਂ ਐਡਵੈਂਚਰਸ ਟ੍ਰਿਪ ਕੋਈ ਤੁਹਾਡੇ ਲਈ ਪਲੈਨ ਆਊਟ ਕਰਲਾਂਗੇ ਅਤੇ ਠੀਕ ਹੈ ਜੀ ਮੈਮ ਮੈਂ ਹੋਟਲ ਤੁਸੀਂ ਕਿਹੜਾ ਲੈਣਾ ਚਾਹੋਂਗੇ ਥ੍ਰੀ ਸਟਾਰ ਮੈਮ ਕੇ ਫਾਈਵ ਸਟਾਰ ਲੈਣਾ ਚਾਹੋਂਗੇ ਠੀਕ ਹੈ ਮੈਮ ਅਤੇ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ ਆਪਾਂ ਸਟਾਟਿੰਗ ਜਿਹੜੀ ਹੈਗੀ ਹੈ ਆਪਣਾ ਕੁਆਲਾ ਲੰਪੁਰ ਤੋਂ ਕਰਾਂਗੇ ਮੈਮ ਇਸ ਟੂਰ ਦੀ ਜਿਹਦੇ 'ਚ ਪੈਟਰੋਨਸ ਟਵਿਨ ਟਾਵਰ ਵੀ ਆਪਾਂ ਵਿਜਿਟ ਕਰਾਂਗੇ ਫਿਰ ਅਸੀਂ ਇਹਨੂੰ ਬਾਟੂ ਕੇਵਸ ਤੱਕ ਲੈ ਕੇ ਜਾਂਦੇ ਹੋਏ ਇੱਦਾਂ ਸਾਰਾ ਤੁਹਾਨੂੰ ਮਲਾਕਾ ਸਿਟੀ ਵਗੈਰਾ ਘੁੰਮਾਵਾਂਗੇ ਇਹਦੇ 'ਚ ਕਰੂਜ਼ ਦੀ ਆਪਾਂ ਰਾਈਡ ਇੱਕ ਰੱਖ ਲੈਂਦੇ ਹਾਂ ਇੱਕ ਆਪਾਂ ਐਡ ਕਰ ਸਕਦੇ ਹਾਂ ਪੈਰਾਕਲਾਈਡਿੰਗ ਜੇ ਤੁਸੀਂ ਪਸੰਦ ਕਰੋ ਮੈਮ ਬਿਲਕੁਲ ਮੈਮ ਬਿਲਕੁਲ ਉਨ੍ਹਾਂ ਨੂੰ ਬਹੁਤ ਅੱਛਾ ਜੇ ਉਹ ਅਡਵੈਂਚਰਸ ਨੂੰ ਪਸੰਦ ਕਰਦੇ ਨੇ ਪੱਕਾ ਉਹ ਬਹੁਤ ਪਸੰਦ ਕਰਨਗੇ ਇਸ ਚੀਜ਼ ਨੂੰ ਅਤੇ ਤੁਹਾਡੇ ਲਈ ਆਪਾਂ ਇੱਦਾਂ ਕਰ ਸਕਦੇ ਮੈਮ ਜੇ ਤੁਹਾਨੂੰ ਇੱਦਾਂ ਇੱਦਾਂ ਦਾ ਅਡਵੈਂਚਰ ਨਹੀਂ ਪਸੰਦ ਤਾਂ ਆਪਾਂ ਜਿਹੜਾ ਹੈਗਾ ਅੰਡਰ ਵਾਟਰ ਜਿਹੜਾ ਹੈਗਾ ਐਕੁਐਰੀਅਮ ਆਪਾਂ ਉਹਦੇ 'ਤੇ ਵਿਜਿਟ ਰੱਖ ਸਕਦੇ ਹਾਂ ਬਹੁਤ ਪਿਆਰਾ ਮੈਮ ਸਮੁੰਦਰ ਦੇ ਅੰਦਰ ਤੁਹਾਨੂੰ ਲੈ ਜਾਂਦੇ ਨੇ ਸਮੁੰਦਰ ਦੇ ਸਾਰੇ ਜੀਵ ਜੰਤੂ ਤੁਹਾਨੂੰ ਦਿਖਣਗੇ ਡਿਫਰੈਂਟ ਲਾਈਵਸ ਹੈਗੀ ਬਹੁਤ ਸ਼ੀਸ਼ਾ ਲੱਗਿਆ ਹੋਇਆ ਪ੍ਰੋਪਰ ਬੜਾ ਮਜ਼ਾ ਆਉਂਦਾ ਮੈਮ ਟਨਲਸ ਹੈਗੀਆਂ ਅੰਦਰ ਬਹੁਤ ਪਿਆਰਾ ਰਹੇਗਾ ਔਰ ਮੈਂ ਸ਼ੋਅਰ ਕਰਦਾ ਤੁਹਾਡਾ ਇਹ ਜਿਹੜਾ ਟ੍ਰਿਪ ਬਹੁਤ ਹੀ ਯਾਦਗਾਰ ਹੋਣ ਵਾਲਾ ਦੋਨਾਂ ਦਾ ਅਤੇ ਇਹਦੇ ਵਾਸਤੇ ਆਪਾਂ ਤੁਹਾਨੂੰ ਟ੍ਰਿਪਲ ਵਿਲਾ ਤੁਹਾਨੂੰ ਪੂਰੀ ਗਾਈਡੈਂਸ ਅਤੇ ਪੂਰੀ ਸਪੋਟ ਮੈਮ ਅਸੀਂ ਪ੍ਰੋਵਾਈਡ ਕਰਾਂਗੇ ਥਰੂ ਆਊਟ ਦਾ ਤੁਹਾਡਾ ਟ੍ਰਿਪ ਅਤੇ ਇਹਦੇ ਬਿਲਕੁਲ ਮੈਮ ਮੈਂ ਕਰਾਂਗਾ ਤੁਹਾਡੇ ਇਸ ਹੀ ਨੰਬਰ 'ਤੇ ਮੈਮ ਤੁਹਾਨੂੰ ਵੱਟਸਅਪ ਕਰਦਾਂਗਾ ਪੈਕੇਜ ਦੀਆਂ ਡਿਟੈਲਸ ਅਤੇ ਅਮਾਊਂਟ ਜੋ ਵੀ ਹੈ ਠੀਕ ਹੈ ਮੈਮ ਥੈਂਕ ਯੂ ਜੀ